ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ ਮੈਂ ਤੁਹਾਨੂੰ ਇਹ ਦੱਸਣ ਲਈ ਫੋਨ ਕੀਤਾ ਸੀ ਕਿ ਮੈਂ ਵੀਹ ਕੁ ਦਿਨ ਪਹਿਲਾਂ ਤੁਹਾਡੇ ਤੋਂ ਇੱਕ ਬੂਟ ਮੰਗਵਾਏ ਸੀ ਇੱਕ ਦਿਨ ਅਚਾਨਕ ਹੀ ਮੈਨੂੰ ਇੰਸਟਾਗ੍ਰਾਮ 'ਤੇ ਦਿਖਾਈ ਦਿੱਤੇ ਅਤੇ ਫਿਰ ਮੈਂ ਔਡਰ ਕੀਤੇ ਬਹੁਤ ਸਮੇਂ ਤੋਂ ਮੈਂ ਉਹ ਬੂਟ ਦੇਖ ਰਿਹਾ ਸੀ ਮੈਨੂੰ ਕਿਤੇ ਵੀ ਉਹ ਮਿਲ ਨਹੀਂ ਰਹੇ ਸੀ ਇਥੋਂ ਤੱਕ ਕਿ ਮੇਰੇ ਸ਼ਹਿਰ ਵਿੱਚ ਬੂਟਾਂ ਦੀਆਂ ਦੁਕਾਨਾਂ 'ਤੇ ਕਿਸੇ ਵੀ ਦੁਕਾਨ 'ਤੇ ਨਹੀਂ ਆਏ ਹੋਏ ਅਜੇ ਉਹ ਮੈਂ ਫਿਰ ਔਡਰ ਕੀਤਾ ਦਸ ਕੁ ਦਿਨ ਦੇ ਵਿੱਚ ਹੀ ਤੁਹਾਡਾ ਔਡਰ ਮੇਰੇ ਕੋਲ ਪਹੁੰਚ ਗਿਆ ਤੁਹਾਡਾ ਡਿਲੀਵਰੀ ਬੋਆਏ ਜਦੋਂ ਮੈਨੂੰ ਔਡਰ ਦੇਣ ਆਇਆ ਤਾਂ ਉਹ ਬਹੁਤ ਹੀ ਵ ਵਧੀਆ ਢੰਗ ਨਾਲ਼ ਉਹਨੇ ਮੈਨੂੰ ਡੀਲ ਕੀਤਾ ਉਹਨੇ ਮੈਨੂੰ ਔਡਰ ਫੜਾਇਆ ਮੈਨੂੰ ਉਹਦਾ ਸੁਭਾਅ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਢੰਗ ਨਾਲ਼ ਮੈਨੂੰ ਮੇਰਾ ਔਡਰ ਦੇ ਕੇ ਚਲਾ ਗਿਆ ਜਦੋਂ ਮੈਂ ਆਪਣਾ ਔਡਰ ਆਪਣੇ ਘਰ ਲੈ ਕੇ ਗਿਆ ਲੈ ਜਾ ਕੇ ਜਦ ਉਹ ਬੋ ਬੋਕਸ ਨੂੰ ਖੋਲ੍ਹਿਆ ਤਾਂ ਮੈਂ ਦੇਖਿਆ ਡੱਬਾ ਬਹੁਤ ਹੀ ਵਧੀਆ ਸੀ ਉਸਦਾ ਬਹੁਤ ਵਧੀਆ ਢੰਗ ਨਾਲ਼ ਪੈਕ ਕੀਤਾ ਹੋਇਆ ਸੀ ਉਸਦੇ ਡੱਬੇ ਦੇ ਦੇਖਣ ਤੋਂ ਹੀ ਪਤਾ ਲੱਗਦਾ ਸੀ ਕਿ ਜਿਸ ਚੀਜ਼ ਦਾ ਬੋਕਸ ਐਨਾ ਵਧੀਆ ਬਣਾਇਆ ਹੋਇਆ ਹੈ ਅੰਦਰ ਚੀਜ਼ ਵੀ ਵਧੀਆ ਹੀ ਹੋਊਗੀ ਜਦੋਂ ਮੈਂ ਬੂਟ ਖੋਲ੍ਹੇ ਤਾਂ ਮੈਨੂੰ ਬੂਟ ਬਹੁਤ ਵਧੀਆ ਲੱਗੇ ਉਹਨਾਂ ਦਾ ਕਲਰ ਵੀ ਬਹੁਤ ਵਧੀਆ ਸੀ ਜੋ ਦਿਖਾੲ ਦਿਖਾਈ ਦੇ ਰਹੇ ਸੀ ਪੇਜ 'ਤੇ ਔਨਲਾਈਨ ਉਸ ਤਰ੍ਹਾਂ ਦੇ ਹੀ ਰ ਦੇਖਣ ਵਿੱਚ ਸਨ ਅਤੇ ਬੂਟਾਂ ਦਾ ਭਾਰ ਬਹੁਤ ਘੱਟ ਸੀ ਜੋ ਕਿ ਵਧੀਆ ਹੈ ਅਤੇ ਉਹ ਬੂਟ ਮੈਂ ਹੁਣ ਜਿੰਮ ਨੂੰ ਪਾਉਣੇ ਸ਼ੁਰੂ ਕੀਤੇ ਜਿਸ ਦਿਨ ਪਹਿਲੇ ਦਿਨ ਪਾਏ ਮੈਂ ਬੂਟ ਪਾਉਣ 'ਤੇ ਇਸ ਤਰ੍ਹਾਂ ਫੀਲ ਹੋਇਆ ਕਿ ਜਿਵੇਂ ਕਿ ਬਹੁਤ ਹੀ ਸੋਫਟ ਚੀਜ਼ ਮੈਂ ਪਾ ਰਿਹਾ ਹਾਂ ਅਤੇ ਪੈਰਾਂ ਨੂੰ ਆਰਾਮ ਮਿਲਿਆ ਅਤੇ ਉਹਦੇ ਤਸਮੇ ਵੀ ਬਹੁਤ ਵਧੀਆ ਹਨ ਅਤੇ ਸੋਲ ਵੀ ਥੱਲਿਉਂ ਬਹੁਤ ਵਧੀਆ ਬਣਾਇਆ ਹੋਇਆ ਹੈ ਡਿਜ਼ਾਇਨ ਬਹੁਤ ਵਧੀਆ ਤਰੀ ਤਰੀਕੇ ਨਾਲ਼ ਕੀਤਾ ਹੋਇਆ ਹੈ ਜਦੋਂ ਮੈਂ ਜਿੰਮ ਪਾ ਕੇ ਗਿਆ ਬੂਟ ਤਾਂ ਮੇਰੇ ਦੋਸਤਾਂ ਨੇ ਬਹੁਤ ਤਾਰੀਫ ਕੀਤੀ ਕਹਿੰਦੇ ਤੇਰੇ ਬੂਟ ਬਹੁਤ ਸੋਹਣੇ ਹਨ ਅਤੇ ਉਹਨਾਂ ਨੇ ਮੈਨੂੰ ਪੁੱਛਿਆ ਤੂੰ ਕਿੱਥੋਂ ਮੰਗਵਾਏ ਫਿਰ ਮੈਂ ਉਹਨਾਂ ਨੂੰ ਦੱਸਿਆ ਇਸ ਸਾਈਟ ਤੋਂ ਮੰਗਵਾਏ ਹਨ ਤਾਂ ਮੈਂ ਤੁਹਾਡਾ ਸਾਰਾ ਅਡਰੈਸ ਦਿੱਤਾ ਅਤੇ ਉਹਨਾਂ ਨੂੰ ਪੇਜ ਦੱਸਿਆ ਉਹ ਕਹਿ ਰਹੇ ਸਨ ਕਿ ਅਸੀਂ ਵੀ ਮੰਗਵਾਉਣਾ ਚਾਹੁੰਦੇ ਹਨ ਮੇਰੇ ਚਾਰ ਦੋਸਤਾਂ ਨੇ ਉਸ ਟਾਈਮ ਹੀ ਔਡਰ ਕਰ ਦਿੱਤੇ ਉਹਨਾਂ ਨੇ ਜਦੋਂ ਬੂਟ ਉਠਾ ਕੇ ਦੇਖੇ ਤਾਂ ਉਹਨਾਂ ਨੂੰ ਵੀ ਮਹਿਸੂਸ ਹੋਇਆ ਕਿ ਬਹੁਤ ਵਧੀਆ ਕੁਆਲਿਟੀ ਦੇ ਹਨ ਉਸ ਤੋਂ ਬਾਅਦ ਜਦ ਮੈਂ ਇੱਕ ਦਿਨ ਆਪਣੀ ਗਲੀ ਦੇ ਵਿੱਚ ਘੁੰਮ ਰਿਹਾ ਸੀ ਤਾਂ ਮੇਰੇ ਗੁਆਂਢੀ ਮੁੰਡੇ ਨੇ ਵੀ ਦੇਖ ਕੇ ਉਹ ਬੂਟ ਔਡਰ ਕੀਤੇ ਮੈਂ ਤੁਹਾਨੂੰ ਇਹੀ ਦੱਸਣ ਲਈ ਫੋਨ ਕੀਤਾ ਕਿ ਬਹੁਤ ਹੀ ਵਧੀਆ ਕੁਆਲਿਟੀ ਦੇ ਬੂਟ ਹਨ ਅਤੇ ਮੈਂ ਬਹੁਤ ਖੁਸ਼ ਹਾਂ ਇਹੋ ਜਿਹੇ ਜੋ ਬੂਟ ਮੈਨੂੰ ਮਿਲੇ ਅਤੇ ਤੁਹਾਡੀ ਕੰਪਨੀ ਨੇ ਜੋ ਬਣਾਏ ਹੈ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ ਬਹੁਤ ਹੀ ਵਧੀਆ ਕੁਆਲਿਟੀ ਦੇ ਹਨ ਮੈਂ ਚਾਹੁੰਦਾ ਹਾਂ ਅੱਗੇ ਤੋਂ ਵੀ ਤੁਹਾਡੇ ਬੂਟ ਹੀ ਖਰੀਦਾਂ ਕਿਉਂਕਿ ਤੁਹਾਡੇ ਬੂਟਾਂ ਦੀ ਕੁਆਲਿਟੀ ਹੈ ਮੈਂ ਉਮੀਦ ਕਰਦਾ ਅੱਗੇ ਤੋਂ ਵੀ ਤੁਹਾਨੂੰ ਹੀ ਔਡਰ ਦੇਵਾਂਗਾ ਧੰਨਵਾਦ ਜੀ